ਪੰਜ ਜੁਲਾਈ ਦੋ ਹਜ਼ਾਰ ਇੱਕੀ ਛੇ ਜੁਲਾਈ ਦੋ ਹਜ਼ਾਰ ਬਾਈ ਬਾਈ ਜੁਲਾਈ ਦੋ ਹਜ਼ਾਰ ਚੌਵੀ ਇੱਕੀ ਮਈ ਦੋ ਹਜ਼ਾਰ ਤੇਈ ਅਠਾਰਾਂ ਜੂਨ ਦੋ ਹਜ਼ਾਰ ਚੌਵੀ